ਪੰਜਾਬੀ ਭਾਸ਼ਾ ਬਾਰੇ ਕੁਛ ਆਮ ਗਲਤ ਧਾਰਨਾਵਾਂ ਇਹ ਹੈ ਕਿ ਪੰਜਾਬੀ ਦਾ ਵਿਕਾਸ ਅਤੇ ਨਿਕਾਸ ਪੂਰਵ ਨਾਨਕ ਕਾਲ ਵਿੱਚ ਹੋਇਆ ਸੀ ਪਰ ਇਹ ਗਲਤ ਹੈ ਪੰਜਾਬੀ ਦੇ ਕੁਛ ਅੱਖਰ ਪੂਰਵ ਨਾਨਕ ਕਾਲ ਤੋਂ ਪਹਿਲਾਂ ਹੀ ਬਣੇ ਹੋਏ ਸਨ ਜਿਵੇਂ ਨ ਓ ਆ ਇਹ ਸ਼ਬਦ ਪਹਿਲਾਂ ਹੀ ਵਰਤੇ ਜਾਂਦੇ ਸਨ ਹੋਰ ਸ਼੍ਰੀ ਗੁਰੂ ਗੋਬੰਦ ਸਿੰਘ ਜੀ ਨੇ ਇਹਨਾਂ ਸ਼ਬਦਾਂ ਨੂੰ ਇੱਕ ਸਹੀ ਕ੍ਰਿਆ ਅਤੇ ਕ੍ਰਮ ਦਿੱਤਾ ਦਿੱਤਾ ਅਤੇ ਪੰਜਾਬੀ ਭਾਸ਼ਾ ਪੰਜਾਬੀ ਪੰਜਾਬ ਦੀ ਭਾਸ਼ਾ ਹੈ ਜਿਸ ਨੂੰ ਪੰਜਾਬ ਖੇਤਰ ਦੇ ਵਿਕਾਸ ਜਾਂ ਸੰਬੰਧਕ ਲੋਕ ਬੋਲਦੇ ਹਨ ਇਹ ਭਾਸ਼ਾ ਦੇ ਹਿੰਦੂ ਯੂਰੋਪੀਅਨ ਪਰਿਵਾਰ ਵਿੱਚੋਂ ਹਿੰਦ ਇਰਾਨੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਇਹ ਪੰਜਾਬ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ ਗੁਰਮੁਖੀ ਲਿੱਪੀ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ ਪੰਜਾਬ ਦੀਆਂ ਦੋ ਮੁੱਖ ਉਪ ਬੋਲੀਆਂ ਹਨ ਪੂਰਬੀ ਪੰਜਾਬੀ ਅਤੇ ਲਹਿੰਦੀ ਪੰਜਾਬੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਨੂੰ ਇੱਕ ਸਹੀ ਕ੍ਰਿਆ ਅਤੇ ਕ੍ਰਮ ਦਿੱਤਾ ਜਿਸ ਨਾਲ ਅੱਜ ਪੰਜਾਬੀ ਅਸੀਂ ਗੁਰਮੁਖੀ ਵਰਤਦੇ ਹਨ ਲਿਪੀ ਲਗਾਖਰ ਇਹ ਸਭ ਦਾ ਇਜਾਤ ਪੂਰਵ ਨਾਨਕ ਕਾਲ ਦੇ ਬਾਅਦ 'ਚ ਹੋਇਆ ਹੈ